ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਕੁਛ ਸਾਲਾਂ ਤੋਂ ਸੈਰ ਸਪਾਟਾ ਕਾਫੀ ਵੱਧ ਗਿਆ ਹੈ ਕਾਫੀ ਟੂਰਿਸਟ ਬਾਹਰੋਂ ਆ ਰਿਹਾ ਹੈ ਔਰ ਕਾਫੀ ਮਦਦ ਹੋ ਰਹੀ ਹੈ ਇਹਦੇ ਵਿੱਚ ਜ਼ਿਆਦਾ ਟੂਰਿਸਟ ਦੇ ਆਉਣ ਨਾਲ ਲੋਕਾਂ ਦੀ ਵਪਾਰ ਦੇ ਵਿੱਚ ਕਾਫੀ ਫਰਕ ਪਿਆ ਹੈ ਕਿਉਂਕਿ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਇੱਥੇ ਆ ਕੇ ਇੱਥੋਂ ਦੀਆਂ ਦੁਕਾਨਾਂ ਦੇ ਉੱਤੇ ਜੋ ਆ ਕੇ ਆਪਣਾ ਖੀਰਦਾ ਖਰੂਦੀ ਕਰਦੇ ਨੇ ਅਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਸਮਾਨ ਉਹਨਾਂ ਨੂੰ ਚਾਹੀਦਾ ਹੈ ਉਹ ਮਿਲ ਜਾਂਦਾ ਹੈ ਔਰ ਸੈਰ ਸਪਾਟਾ ਵਧਣ ਦੇ ਨਾਲ ਕੰਮ ਵੀ ਵੱਧਦਾ ਔਰ ਤੁਸੀਂ ਦੇਖੋ ਹੋਗੇ ਪਿਛਲੇ ਕੁਛ ਦਿਨਾਂ ਤੋਂ ਬਾਅਦ ਇੱਥੇ ਹੋਟਲ ਇੰਡਸਟਰੀ ਦਾ ਵੀ ਕਾਫੀ ਅੱਛਾ ਕੰਮ ਹੋ ਗਿਆ ਹੈ ਹੋਟਲ ਕਾਫੀ ਖੁੱਲ੍ਹ ਗਏ ਹਨ ਹੋਟਲ ਵਾਲਿਆਂ ਨੂੰ ਕਾਫੀ ਰਾਹਤ ਹੈ ਕਿਉਂਕਿ ਹੋਟਲ ਖੁੱਲ੍ਹਣ ਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਹੁੰਦੀ ਹੋਟਲ ਉੱਥੇ ਆਸ ਪਾਸ ਬਣੇ ਹੋਏ ਉਹਨਾਂ ਲੋਕਾਂ ਨੂੰ ਬਜਟ ਦੇ ਵਿੱਚ ਹੋਟਲ ਮਿਲ ਜਾਂਦੇ ਔਰ ਖਾਣੇ ਦੇ ਵਾਈਸ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਖਾਣਾ ਬਹੁਤ ਹੀ ਵਧੀਆ ਹੈ ਵੱਖ ਵੱਖ ਜਗ੍ਹਾ 'ਤੇ ਬਹੁਤ ਬਹੁਤ ਸਪੈਸ਼ਪੈਲਿਟੀ ਹੈ ਹਰ ਜਗ੍ਹਾ ਦਾ ਔਰ ਇੱਥੇ ਤਾਂ ਅੰਮ੍ਰਿਤਸਰੀ ਕੁਲਚਾ ਵੀ ਬੜਾ ਮਸ਼ਹੂਰ ਹੈ ਪੂੜੀਆਂ ਬਹੁਤ ਵਧੀਆ ਮਿਲਦੀਆਂ ਹਨ ਔਰ ਲੋਕ ਬੜੇ ਚਾਅ ਨਾਲ ਇੱਥੇ ਘੁੰਮਣ ਆਉਂਦੇ ਹਨ ਔਰ ਉਹਨਾਂ ਲੋਕਾਂ ਨੂੰ ਵੀ ਉਹਨਾਂ ਲੋਕਾਂ ਦਾ ਵੀ ਕਾਫੀ ਐਡ ਹੋ ਜਾਂਦੀ ਹੈ ਕਿਉਂਕਿ ਆਹਨਾਂ ਦਾ ਇੱਥੇ ਕੁਲਚੇ ਵਾਲੇ ਬਹੁਤ ਮਸ਼ਹੂਰ ਹਨ ਜਿਸ ਤਰ੍ਹਾਂ ਮੋਨੂੰ ਕੁਲਚੇ ਵਾਲਾ ਇੱਥੇ ਅੰਮ੍ਰਿਤਸਰ 'ਚ ਬਹੁਤ ਜ਼ਿਆਦਾ ਫੇਮਸ ਹੈ ਔਰ ਉਹ ਕੁਲਚਾ ਬਹੁਤ ਵਧੀਆ ਹੈ ਲੋਕ ਖਾ ਕੇ ਬੜਾ ਖੁਸ਼ ਹੁੰਦੇ ਹਨ ਔਰ ਹੋਰ ਵੀ ਬੜੀ ਤਰ੍ਹਾਂ ਦਾ ਇੱਥੇ ਬਿਜ਼ਨਸ ਜਿਹੜਾ ਆ ਰਿਹਾ ਹੈ ਟੂਰਿਸਟ ਵੱਧ ਰਿਹਾ ਹੈ ਬਾਹਰੋਂ ਦੇਖਿਆ ਜਾਂਦਾ ਹੈ ਅਕਸਰ ਪਹਿਲੇ ਅਸੀਂ ਸੰਡੇ ਦੇ ਦਿਨ ਗੋਲਡਨ ਟੈਂਪਲ ਘੁੰਮਣ ਜਾਈਦਾ ਸੀ ਅਤੇ ਇੰਨਾਂ ਰਸ਼ ਨਹੀਂ ਸੀ ਹੁੰਦਾ ਹੁਣ ਗੋਲਡਨ ਟੈਂਪਲ ਸੰਡੇ ਵਾਲੇ ਦਿਨ ਜਾਓ ਅਤੇ ਉੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਟੂਰਿਸਟ ਹਰ ਵੇਲੇ ਇੱਥੇ ਆਇਆ ਹੀ ਰਹਿੰਦਾ ਹੈ ਔਰ ਟੂਰਿਸਟ ਦੇ ਨਾਲ ਆਉਣ ਨਾਲ ਸ਼ਹਿਰ ਦੇ ਵਿੱਚ ਕਾਫੀ ਬਿਜ਼ਨਸ ਜਿਹੜਾ ਹੈ ਮਿਲ ਜਾਂਦਾ ਹੈ